ਸਾਡੇ ਇਲਾਕੇ ਵਿੱਚ ਲੋਕ ਵੱਖ ਵੱਖ ਥਾਵਾਂ 'ਤੇ ਯਾਤਰਾ ਕਰਨਾ ਪਸੰਦ ਕਰਦੇ ਹਨ ਜਿਵੇਂ ਕੁਝ ਲੋਕ ਪਹਾੜਾਂ 'ਤੇ ਕੁਝ ਇਤਿਹਾਸਿਕ ਅਤੇ ਕੁਝ ਲੋਕ ਧਾਰਮਿਕ ਸਥਲਾਂ 'ਤੇ ਯਾਤਰਾ ਕਰਨਾ ਪਸੰਦ ਕਰਦੇ ਹਨ ਜੀਂ ਜਿਵੇਂ ਪੰਜਾਬ ਤੋਂ ਗੋਆ ਬਹੁਤ ਦੂਰ ਹੈ ਅਤੇ ਪੰਜਾਬ ਦੇ ਪਠਾਨਕੋਟ ਵਿੱਚ ਬਹੁਤ ਹੀ ਮਸ਼ਹੂਰ ਜਗ੍ਹਾ ਮਿੰਨੀ ਗੋਆ ਹੈ ਲੋਕ ਇਸ ਜਗ੍ਹਾ ਨੂੰ ਬਹੁਤ ਹੀ ਚਾਅ ਨਾਲ ਵੇਖਣ ਲਈ ਆਉਂਦੇ ਹਨ ਅਤੇ ਇੱਥੇ ਘੁੰਮਣ ਫਿਰਨ ਦੇ ਲਈ ਵੀ ਜਾਂਦੇ ਹਨ ਇੱਥੇ ਬਹੁਤ ਹੀ ਯਾਤਰੀ ਆਉਂਦੇ ਹਨ ਅਤੇ ਪਠਾਨਕੋਟ ਦੀ ਮਸ਼ਹੂਰ ਰਣਜੀਤ ਸਾਗਰ ਡੈਮ ਮੁਕਤੇਸ਼ਵਰ ਧਾਮ ਵਿੱਚ ਵੀ ਲੋਕ ਦੂਰੋਂ ਦੂਰੋਂ ਯਾਤਰਾ ਕਰਨ ਲਈ ਆਉਂਦੇ ਹਨ ਇਸ ਤੋਂ ਇਲਾਵਾ ਲੋਕ ਡਲਹੋਜ਼ੀ ਧਰਮਸ਼ਾਲਾ ਮਕਲੋਡਗੰਜ ਆਦਿ ਵੀ ਯਾਤਰਾ ਕਰਨਾ ਪਸੰਦ ਕਰਦੇ ਹਨ ਕਿਉਂਕਿ ਉੱਥੋਂ ਦਾ ਸੁਹਾਵਣਾ ਮੌਸਮ ਸ਼ਾਂਤੀ ਨੀ ਨੀਲਾ ਆਸਮਾਨ ਨਦੀਆਂ ਝਰਨੇ ਆਦਿ ਦਿਲ ਨੂੰ ਬਹੁਤ ਸਕੂਨ ਦਿੰਦੇ ਹਨ ਇਸ ਕਰਕੇ ਕੁ ਜ਼ਿਆਦਾਤਰ ਲੋਕ ਪਹਾੜੀ ਖੇਤਰਾਂ ਵਿੱਚ ਯਾਤਰਾ ਕਰਨਾ ਪਸੰਦ ਕਰਦੇ ਹਨ ਕੁਝ ਲੋਕ ਧਾਰਮਿਕ ਸਥਾਨਾਂ 'ਤੇ ਯਾਤਰਾ ਕਰਨਾ ਵੀ ਪਸੰਦ ਕਰਦੇ ਹਨ ਉਹ ਇਸ ਕਰਕੇ ਕਿਉਂਕਿ ਇਸ ਨਾਲ ਸਾਨੂੰ ਆਪਣੇ ਧਰਮ ਨਾਲ ਸ ਜੁੜੀ ਸਾਰੀ ਇਤਿਹਾਸਿਕ ਚੀਜ਼ਾਂ ਦੀ ਜਾਣਕਾਰੀ ਮਿਲਦੀ ਹੈ ਅਤੇ ਇਤਿਹਾਸਿਕ ਥਾਵਾਂ 'ਤੇ ਯਾਤਰਾ ਕਰਨ ਨਾਲ ਸਾਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗਦਾ ਹੈ ਜਿਸ ਨਾਲ ਸਾਨੂੰ ਆਪਣੇ ਇਤਿਹਾਸ ਨੂੰ ਕਿਸੇ ਸਮੇਂ ਦਰਸਾਉਣ ਲਈ ਝੁਕਣਾ ਜਾਂ ਸ਼ਰਮਾਉਣਾ ਨਹੀਂ ਪੈਂਦਾ